ਹਾਂਜੀ ਸਾਨੂੰ ਕੁਛ ਟਾਇਮ ਪਹਿਲਾਂ ਇਹ ਬਹੁਤ ਦਿੱਕਤ ਆਈ ਸੀਗੀ ਸਾਡੇ ਇੱਥੇ ਬਹੁਤ ਸਾਰੇ ਜੋ ਮੁੰਡੇ ਨਸ਼ੇ ਕਰਦੇ ਨੇ ਉਹਨਾਂ ਨੂੰ ਲੈ ਕੇ ਅਸੀਂ ਬਹੁਤ ਸ਼ਿਕਾਇਤ ਕੀਤੀ ਸੀਗੀ ਪੁਲਿਸ ਥਾਣੇ ਵਿੱਚ ਵੀ ਇੱਥੇ ਦੇ ਲੋਕ ਨਸ਼ੇ ਕਰਦੇ ਨੇ ਐਵੇਂ ਐਰਾ ਵਗੈਰਾ ਵੀ ਫਿਰ ਨਸ਼ੇ ਵਿੱਚ ਟੈਟ ਹੋ ਕੇ ਬਾਹਰ ਗਿਰਦੇ ਫਿਰਦੇ ਰਹਿੰਦੇ ਨੇ ਅਤੇ ਫਿਰ ਲੜਦੇ ਨੇ ਲੜਾਈਆਂ ਕਰਦੇ ਨੇ ਬੇਫਾਲਤੂ ਦੀਆਂ ਅਤੇ ਇਹਦੀ ਬਹੁਤ ਵਾਰ ਅਸੀਂ ਸ਼ਿਕਾਇਤ ਕੀਤੀ ਹੈ ਪਰ ਇਸ ਦੇ ਉੱਪਰ ਕਦੇ ਕੋਈ ਕਾਨੂੰਨੀ ਕੰਮ ਨਹੀਂ ਹੋਇਆ ਪੁਲਿਸ ਵਾਲੇ ਆ ਜਾਂਦੇ ਸੀ ਚਲੇ ਜਾਂਦੇ ਸੀਗੇ ਪੈਸੇ ਲੈ ਲੈਂਦੇ ਸੀਗੇ ਸਾਡੇ ਤੋਂ ਫਿਰ ਕਹਿੰਦੇ ਤੁਹਾਡਾ ਕੰਮ ਹੋਜੂਗਾ ਪਰ ਉਹ ਕੰਮ ਕਰਦੇ ਨਹੀਂ ਸੀ ਅਤੇ ਅਸੀਂ ਅੱਗੇ ਤੋਂ ਅੱਗੇ ਬਹੁਤ ਮਤਲਬ ਇਹਨਾਂ ਨੂੰ ਤੰਗ ਹੋਏ ਪੁਲਿਸ ਵਾਲਿਆਂ ਤੋਂ ਅੱਗੇ ਤੋਂ ਅੱਗੇ ਕਦੇ ਏ ਇੱਕ ਦਿਨ ਦਾ ਕਦੇ ਦੋ ਦਿਨ ਕਹਿੰਦੇ ਤੁਹਾਡਾ ਹੱਲ ਹੋਜੂਗਾ ਪਰ ਕਦੇ ਕਰਦੇ ਨਹੀਂ ਸੀ ਫਿਰ ਕਹਿੰਦੇ ਇੰਨੇ ਪੈਸੇ ਦਿਓ ਇੰਨੇ ਪੈਸੇ ਐਵੇਂ ਕਰਾਂਗੇ ਐਵੇਂ ਪਰਚਾ ਹੋਊ ਐਵੇਂ ਹੋਊ ਫਲਾਣਾ ਟਮਕਾਣਾ ਪਰ ਇਹਨੇ ਕਦੇ ਕੰਮ ਨਹੀਂ ਕੀਤਾ ਸਾਡਾ ਅਤੇ ਉਹ ਜੋ ਨੌਜਵਾਨ ਮੁੰਡੇ ਨਸ਼ਿਆਂ ਵਿੱਚ ਲੱਗੇ ਉਹਨਾਂ ਨੂੰ ਲੈ ਕੇ ਵੀ ਇਹਨਾਂ ਨੇ ਕੁਛ ਵੀ ਕੰਮ ਨਹੀਂ ਕੀਤਾ ਉਹ ਜਿਵੇਂ ਦੇ ਸੀਗੇ ਉਵੇਂ ਹੀ ਰਹੇ ਜੇ ਕੋਈ ਚਾ ਜੇ ਕੋਈ ਨਸ਼ਾ ਕਰਦੇ ਸੀ ਕਿਸੇ ਨੂੰ ਦੱਸ ਦਿੰਦੇ ਪੁਲਿਸ ਵਾਲੇ ਨੂੰ ਤਾਂ ਅੱਗੋਂ ਉਹ ਵਾਪਸ ਕੋਈ ਕਾਰਵਾਈ ਨਹੀਂ ਕਰਦੇ ਸੀ ਜਵਾਬੀ ਕਾਰਵਾਈ ਅਤੇ ਉਹ ਅੱਜ ਕੱਲ੍ਹ ਨੌਜਵਾਨ ਨਸ਼ਾ ਬਹੁਤ ਕਰ ਰਿਹਾ ਜਿਸ ਕਰਕੇ ਨੌਜਵਾਨ ਦੀ ਜ਼ਿੰਦਗੀ ਖਤਮ ਹੁੰਦੀ ਜਾ ਰਹੀ ਹੈ ਪਰ ਜੋ ਕਿ ਪੁਲਿਸ ਕਾਰਵਾਈ ਬਣਦੀ ਹੈ ਪੁਲਿਸ ਨਹੀਂ ਕਰ ਰਹੀ ਆਪਣੀ ਕਾਰਵਾਈ ਜਿਸ ਕਰਕੇ ਸਾਨੂੰ ਬਹੁਤ ਦਿੱਕਤ ਆਈ ਪੁਲਿਸ ਆਪਣਾ ਕੋਈ ਵੀ ਕੰਮ ਪੂਰੇ ਸਹਿਯੋਗ ਨਾਲ ਨਹੀਂ ਕਰ ਰਹੀ ਉਹਨਾਂ ਨੂੰ ਬਸ ਪੈਸਿਆਂ ਤੋਂ ਮਤਲਬ ਹੈ ਜੇ ਪੈਸਾ ਦਊਂਗੇ ਤਾਂ ਕੰਮ ਕਰ ਰਹੀ ਹੈ ਪਰ ਸਾਡਾ ਕੰਮ ਆ ਜੋ ਬਹੁਤ ਔਖਾ ਬਹੁਤ ਟਾਈਮ ਲਾ ਕੇ ਹੋਇਆ ਜਦੋਂ ਅਸੀਂ ਉੱਪਰ ਤੋਂ ਉੱਪਰ ਸ਼ਿਕਾਇਤ ਕਰੀ ਦੈਨ ਕਿਤੇ ਜਾ ਕੇ ਸਾਡਾ ਕੰਮ ਹੋਇਆ ਇਸ ਕਰਕੇ ਸਾਨੂੰ ਪੁਲਿਸ ਵਾਲਿਆਂ ਤੋਂ ਇਹੀ ਸ਼ਿਕਾਇਤ ਹੈ ਵੀ ਉਹ ਕੰਮ ਨੂੰ ਆਪਦੀ ਸੰਸੀਅਰਟੀ ਨਾਲ ਪੂਰਾ ਕਰਨ